ਹੈਲੋ ਹਾਂਜੀ ਇਹ ਵਰਲਡ ਵੀਲ ਕੈਬ ਸਰਵਿਸ ਇਹ ਆਪਣੇ ਗੁਰਦਾਸਪੁਰ ਤੋਂ ਚੰਡੀਗੜ੍ਹ ਤੁਹਾਡੀ ਜਿਹੜੀ ਕੈਬ ਆ ਕਿੰਨੇ ਵਜੇ ਚੱਲਦੀ ਜੇ ਦੋ ਕੁ ਵਜੇ ਤੱਕ ਉੱਥੇ ਪੁੱਜ ਜਾਂਦੇ ਠੀਕ ਠੀਕ ਹੈ

ਠੀਕ ਠੀਕ ਹੈ ਅਤੇ ਆਪਣੇ ਕੈਬ ਦੇ ਵਿੱਚ ਏ ਸੀ ਫੈਸੀਲੀਟੀ ਹੈਗੀ ਆ ਏ ਸੀ ਨਹੀਂ ਚਲਦਾ ਨਹੀਂ ਆ ਨਹੀਂ ਹੁਣ ਪਤਾ ਕੀ ਹੈ ਗਰਮੀ ਦਾ ਮੌਸਮ ਆ ਅਤੇ ਇਸ ਕਰਕੇ ਮੈਂ ਕਹਿੰਦਾ ਪਿਆ ਜੀ ਏ ਸੀ ਦੀ ਫੈਸੀਲੀਟੀ ਤਾਂ ਚਾਹੀਦੀ ਸੀ ਨਾ ਚਾਰਜ ਚਾਰਜਿਸ ਵੱਧ ਜਾਂਦੇ ਆ ਕਿੰਨ ਕਿੰਨੇ ਕ ਚਾਰਜਿਸ ਦਾ ਫਰਕ ਆ ਨਾਰਮਲ ਚਾਰਜਿਸ ਤੇ ਹੈਗਾ ਏ ਸੀ ਚਾਰਜ ਦਾ ਕਿੰਨਾ ਕੁ ਫਰਕ ਆ ਚਲੋ ਜੋ ਵੀ ਹੈ ਏ ਸੀ ਦਾ ਪ੍ਰਬੰਧ ਤੁਸੀਂ ਕਰ ਦੇਣਾ ਠੀਕ ਆ

ਉਹੀ ਕੈਬ ਭੇਜਿਓ ਜੀ ਜਿਸ 'ਚ ਜਿਸ 'ਚ ਏ ਸੀ ਹੋਵੇ ਨੌਂ ਤੋਂ ਬਾਅਦ ਵੀ ਕੋਈ ਕੈਬ ਚੱਲ ਮਿਲ ਸਕਦੀ ਜਦੋਂ ਮਰਜ਼ੀ ਇਹ ਇਹ ਮਤਲਬ ਚਲੋ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਨੌਂ ਦਸ ਦੇ ਵਿੱਚ ਵਿੱਚ ਹੀ ਹੈ ਕੋਈ ਆਪਣਾ ਟਾਈਮ ਜਦੋਂ ਡਿਸਾਈਡ ਹੁੰਦਾ ਦੱਸ ਦਿੰਦੇ ਤੁਹਾਨੂੰ ਮੈਂ ਕਨਫਰਮ ਕਰਨਾ ਸੀ ਏ ਸੀ ਬਾਰੇ ਮੇਨ

ਠੀਕ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਓਕੇ